ਸਤਾਈ ਮਾਰਚ ਉੱਨੀ ਸੌ ਚੁਰਾਸੀ ਨੌਂ ਜਲਾਈ ਉੱਨੀ ਸੌ ਚੁਰਾਸੀ ਚੌਵੀ ਜਨਵਰੀ ਦੋ ਹਜ਼ਾਰ ਅੱਠ ਛੇ ਮਈ ਦੋ ਹਜ਼ਾਰ ਗਿਆਰਾਂ ਬਾਰਾਂ ਜੂਨ ਉੱਨੀ ਸੌ ਛਿਆਹਠ